ਜਲੇਬੀ ਗੁਲਾਬ ਜਾਮਨ ਕਾਲਾ ਜਾਮਨ ਰਸਗੁੱਲਾ ਬਰਫ਼ੀ ਕਾਜੂ ਬਰਫ਼ੀ ਬਦਾਮ ਬਰਫ਼ੀ ਪੀਸਤਾ ਬਰਫ਼ੀ ਬੇਸਨ ਦੀ ਬਰਫ਼ੀ ਢੋਡਾ ਬਰਫ਼ੀ ਨਾਰੀਅਲ ਬਰਫ਼ੀ ਚ ਚਨੇ ਦੇ ਲੱਡੂ ਬੇਸਨ ਲੱਡੂ ਮੋਤੀਚੂਰ ਦੇ ਲੱਡੂ ਤਿਲ ਲੱਡੂ ਸੂਜੀ ਦੇ ਲੱਡੂ ਪਿੰਨੀ ਸੂਜੀ ਪਿੰਨੀ ਸੁਕੀ ਪਿੰਨੀ ਪਤੀਸਾ ਬਾਲੂ ਸ਼ਾਹੀ ਪੇੜਾ ਮਿਕਸ ਪੇੜਾ ਮਾਵਾ ਪੇੜਾ ਮਿਲਕ ਕੇਕ ਸੇਵੀਆਂ ਦੀ ਖੀਰ ਖੀਰ ਫਲੂਦਾ ਚੌਂਕੀ ਲੱਡੂ ਸੰਧੂਰ ਬਰਫ਼ੀ ਚੌਂਕੀ ਬਰਫ਼ੀ ਰਸਮਲਾਈ ਅੰਗੂਰੀ ਰਸ ਮਲਾਈ ਮਲਾਈ ਚਾਂਪ ਮੱਖਣ ਮਿਸਰੀ ਮਲਾਈ ਬਰਫ਼ੀ ਪੰਜੀਰੀ ਸੋਂਦੀ ਪੰਜੀਰੀ ਚੰਮਪਕਲੀ ਫੇਨੀ ਸੇਵੀਆਂ ਮਾਲ ਪੂਆ ਗਾਜਰ ਦਾ ਹਲਵਾ ਮੂੰਗ ਦਾਲ ਦਾ ਹਲਵਾ ਬੇਸਨ ਦਾ ਹਲਵਾ ਸੂਜੀ ਦਾ ਹਲਵਾ ਕਲਾਕੰਦ ਮਿਸਰੀ ਮਾਵਾ ਗੁੜ ਦੀ ਰੇਵੜੀ ਗੁੜ ਪੱਟੀ ਦੁੱਧ ਵੜੀ ਦੁੱਧ ਪਕੌੜੀ ਖਜੂਰ ਦੀ ਬਰਫ਼ੀ ਮੱਖਣ ਬਰਫ਼ੀ ਅੰਬ ਵਾਲੀ ਬਰਫ਼ੀ ਸਿੰਘਾੜਾ ਹਲਵਾ ਆਲੂ ਦਾ ਹਲਵਾ ਮਖਾਣਾ ਖੀਰ ਕਰੀਮ ਟੋਸਟ ਚੌਂਕੀ ਹਲਵਾ ਘੰਟੀ ਰੇਵੜੀ ਸਾਹ ਸ਼ੱਕਰਪਾਰਾ ਚੋਕਲੇਟ ਬਰਫ਼ੀ ਪਿਸਤਾ ਰੋਲ ਗੁਲਕੰਦ ਬਰਫ਼ੀ ਸੰਗਮ ਬਰਫ਼ੀ ਦਾਲ ਖਟਾਈ ਬਦਾਮੀ ਹਲਵਾ ਚੌਕਲੇਟ ਲੱਡੂ ਨਾਰੀਅਲ ਲੱਡੂ ਖ਼ਸਖ਼ਸ ਹਲਵਾ ਮਲਾਈ ਟੋਸਟ ਲਾਲ ਪੇੜਾ ਅਖਰੋਟ ਹਲਵਾ ਫਲਾਹਾਰੀ ਬਰਫ਼ੀ ਆਦਿ ਧੰਨਵਾਦ